ਇੱਕ ਵਾਰੀ ਮੈਂ ਟਰੈਕਿੰਗ ਕਰਦੀ ਹੋਈ ਪਹਾੜੀ ਇਲਾਕੇ ਵਿੱਚ ਗਈ ਉਸ ਟਰੈਕਿੰਗ ਦੇ ਵਿੱਚ ਮੈਨੂੰ ਇੱਕ ਬਹੁਤ ਹੀ ਦਿਲਕਸ਼ਮੀ ਚੀਜ਼ ਜੋ ਅਣਖਿੱਚਵੀ ਚੀਜ਼ ਜਿਹੜੀ ਮੈਨੂੰ ਉਹ ਲੱਗੀ ਕਿ ਮਤਲਬ ਬਹੁਤ ਸੁੰਦਰ ਉਹਦਾ ਦ੍ਰਿਸ਼ ਸੀ ਉਸ ਵਿੱਚ ਮੈਂ ਦੇਖਿਆ ਕਿ ਕਿਵੇਂ ਸੂਰਜ ਨਿਕਲ ਰਿਹਾ ਹੈ ਅਤੇ ਉਸ ਨਿਕਲਦੇ ਹੋਏ ਸੂਰਜ ਨੂੰ ਜਦੋਂ ਪਹਾੜਾਂ ਵਿੱਚ ਇੱਦਾਂ ਮੂੰਹ ਅੱਡ ਕੇ ਜਿਸ ਤਰ੍ਹਾਂ ਨਿਕਲ ਰਿਹਾ ਸੀ ਬਹੁਤ ਹੀ ਸੋਹਣਾ ਲੱਗਾ ਉੱਥੋਂ ਦੀਆਂ ਬਰਫ਼ ਦੀਆਂ ਪਹਾੜੀਆਂ ਉੱਥੋਂ ਦੀਆਂ ਬਰਫ਼ ਦੇ ਦ੍ਰਿਸ਼ ਮੈਨੂੰ ਬਹੁਤ ਹੀ ਸੋਹਣੇ ਲੱਗੇ ਉਸ ਵਿੱਚ ਫਿਰ ਮੈਂ ਟਰੈਕਿੰਗ ਕਰਦੀ ਜਦੋਂ ਥੋੜ੍ਹੀ ਜਿਹੀ ਅੱਗੇ ਵਧੀ ਅਤੇ ਮੈਨੂੰ ਬਹੁਤ ਸਾਰੇ ਇਹੋ ਜਿਹੇ ਪੰਛੀ ਮਿਲੇ ਜੋ ਮੈਂ ਕਦੇ ਨਹੀਂ ਸੀ ਦੇਖੇ ਉਹਨਾਂ ਦੀ ਹਲਕੀ ਹਲਕੀ ਚਹਿਚਹਾਟ ਉਹ ਮੈਨੂੰ ਬਹੁਤ ਹੀ ਸੋਹਣੀ ਲੱਗੀ ਉਹ ਸਾਰੀਆਂ ਉਹਨਾਂ ਦੇ ਪੰਛੀਆਂ ਦੀ ਆਵਾਜ਼ਾਂ ਮੇਰੇ ਮਨ ਨੂੰ ਇੱਦਾਂ ਮੋਹ ਲਈਆਂ ਜਿਵੇਂ ਮੈਨੂੰ ਬਹੁਤ ਉੱਥੇ ਇ ਇਹ ਨਜ਼ਾਰਾ ਦੇਖ ਕੇ ਮੈਂ ਕਦੇ ਘਰ ਹੀ ਨਾ ਵਾਪਸ ਆਵਾਂ ਫਿਰ ਜਦੋਂ ਮੈਂ ਟਰੈਕ ਕਰਦੀ ਹੋਈ ਅੱਗੇ ਹੋਰ ਮੈਨੂੰ ਇਹੋ ਜਿਹੇ ਪੇੜ ਪੌਦੇ ਜਿਹੜੇ ਮੈਂ ਕਦੇ ਜਦੋਂ ਅਸੀਂ ਕਾਰਾਂ ਵਿੱਚ ਜਾਂਦੇ ਹਾਂ ਅਤੇ ਸਾਰੀਆਂ ਚੀਜ਼ਾਂ ਸਾਡੇ ਹੱਥੋਂ ਨਿਕਲ ਜਾਂਦੀਆਂ ਲੇਕਿਨ ਟਰੈਕਿੰਗ ਕਰਦੇ ਹੋਏ ਸਾਨੂੰ ਇਹੋ ਜਿਹੇ ਪੇੜ ਪੌਦੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਜੋ ਅਸੀਂ ਕਦੇ ਵੀ ਨਹੀਂ ਦੇਖ ਦੀਆਂ ਹੋਇਆਂ ਅਤੇ ਫਿਰ ਮੈਂ ਇਹਨਾਂ ਦੀ ਸਾਰੀਆਂ ਪੰਛੀਆਂ ਦੀਆਂ ਸਾਰੇ ਪੇੜਾਂ ਦੀਆਂ ਵਿੱਚੋਂ ਜਿਹੜੇ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਜਿਹੜੇ ਬਹੁਤ ਵੱਡੇ ਵੱਡੇ ਕਈ ਛੋਟੇ ਛੋਟੇ ਪੇੜ ਵੀ ਜਿਹੜੇ ਮੈਨੂੰ ਬਹੁਤ ਚੰਗੇ ਲੱਗੇ ਸਾਰਿਆਂ ਦੀਆਂ ਫੋਟੋਆਵਾਂ ਮੈਂ ਖਿੱਚ ਲੈਂਦੀ ਹਾਂ ਅਤੇ ਇਹਨਾਂ ਨੂੰ ਮੈਂ ਪੋਸਟ ਵੀ ਕਰ ਦਿੰਦੀ ਹਾਂ ਅਤੇ ਇਹਨਾਂ ਨੂੰ ਪੋਸਟ ਕਰਕੇ ਫਿਰ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਤਾਂ ਕਿ ਜਿਹੜੀਆਂ ਚੀਜ਼ਾਂ ਮੈਂ ਦੇਖ ਸਕੀ ਜਿਹੜੀਆਂ ਆਵਾਜ਼ਾਂ ਮੈਂ ਸੁਣ ਸਕੀ ਹਾਂ ਤਾਂ ਕਿ ਉਹ ਬਾਕੀ ਲੋਕ ਵੀ ਉਹ ਪੰਛੀਆਂ ਨੂੰ ਦੇਖ ਸਕਣ ਜਿਹੜੇ ਉਹ ਕਦੇ ਵੀ ਨਹੀਂ ਉਹਨਾਂ ਨੇ ਦੇਖੇ ਹੁੰਦੇ